ਸਾਡੀ ਲੈਂਡਲਾਈਨ ਸੇਵਾਵਾਂ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹਨ ਸਾਡੀ ਕਾਲਿੰਗ ਬਹੁਤ ਕੱਟ ਕੱਟ ਕੇ ਆ ਰਹੀ ਹੈ ਕਿਸੇ ਵੀ ਕਾਲ ਸੁਣਨੀ ਵੀ ਸਾਨੂੰ ਬਹੁਤ ਹੀ ਮੁਸ਼ਕਲ ਹੋ ਰਹੀ ਹੈ ਉਹਨਾਂ ਦੀ ਸਾਨੂੰ ਗੱਲ ਸਮਝ ਹੀ ਨਹੀਂ ਆਉਂਦੀ ਇਸ ਕਰਕੇ ਸਾਨੂੰ ਜਲਦ ਤੋਂ ਜਲਦ ਸਾਡੀ ਔਨਲਾਈਨ ਲਾਈਨ ਕਾਲਿੰਗ ਸੇਵਾ ਨੂੰ ਸਹੀ ਕੀਤਾ ਜਾਵੇ ਅਸੀਂ ਆਪਣੀ ਲੋਕੇਸ਼ਨ ਤੁਹਾਨੂੰ ਭੇਜ ਰਹੇ ਹਾਂ ਸਾਨੂੰ ਇਸ ਲੋਕੇਸ਼ਨ 'ਤੇ ਸੇਵਾ ਮੁਹੱਈਆ ਕਰਵਾਈ ਜਾਵੇ ਅਸੀਂ ਬੋਏ ਸ਼ਸ਼ਕਤੀ ਮੰਦਿਰ ਨੀਜ ਨੀਅਰ ਔਰ ਗਰੇਵਾਲ ਆਟਾ ਚੱਕੀ ਦੇ ਕੋਲ ਰਹਿੰਦੇ ਹਾਂ ਸਾਨੂੰ ਬਹੁਤ ਹੀ ਦਿਨਾਂ ਤੋਂ ਇਹ ਮੁਸ਼ਕਿਲ ਆ ਰਹੀ ਹੈ ਕਿਸੀ ਐਮਰਜਸੀ ਗੱਲ ਵੀ ਕਰਨੀ ਹੋਵੇ ਤਾਂ ਸਾਨੂੰ ਬੜੀ ਹੀ ਪਰੇਸ਼ਾਨੀ ਹੋ ਰਹੀ ਹੈ ਇਸ ਕਰਕੇ ਜਲਦੀ ਹੀ ਸਾਡੀ ਇਹ ਸੇਵਾ ਮੁਕੰਮਲ ਕਰਵਾਈ ਜਾਏ ਅਸੀਂ ਹੋਟਲਾਈਨ ਹੈਲਪਲਾਈਨ ਨੰਬਰ ਇੱਕ ਅੱਠ ਛੁਨਿਆ ਛੁਨਿਆ ਚਾਰ ਜ਼ੀਰੋ ਚਾਰ ਜ਼ੀਰੋ ਚਾਰ ਜ਼ੀਰੋ ਚਾਰ ਜ਼ੀਰੋ 'ਤੇ ਫੋਨ ਕੀਤਾ ਆਪਣੀ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸਾਨੂੰ ਜਲਦ ਹੀ ਸੇਵਾ ਮੁਹੱਈਆ ਕਰਵਾਈ ਜਾਵੇ ਧੰਨਵਾਦ